ਟੈਕਨੋਲੋਜੀ ਸਾਡੇ ਕਾਰੋਬਾਰ ਕਰਨ ਅਤੇ ਲੈਣ ਦੇਣ ਕਰਨ ਦੇ ਤਰੀਕਿਆਂ ਨੂੰ ਬਦਲ ਰਹੀ ਹੈ ਅਸੀਂ ਘਰ ਬੈਠ ਕੇ ਹੀ ਓਰਡਰ ਕਰ ਸਕਦੇ ਹਾਂ ਜੋ ਵੀ ਸਾਡਾ ਦਿਲ ਕਰੇ ਅਸੀਂ ਉਹ ਮੰਗਵਾ ਸਕਦੇ ਹਾਂ ਜਿੱਦਾਂ ਕਿ ਬਲਿੰਕਇਟ ਜੋਮੈਟੋ ਹੋ ਗਿਆ ਸਵਿਗੀ ਹੋ ਗਿਆ ਬਲਿੰਕਇਟ ਜਿਹੜਾ ਹੈ ਉਹ 'ਤੇ ਅਸੀਂ ਕੁਝ ਵੀ ਆਪਣਾ ਘਰ ਦਾ ਰਾਸ਼ਨ ਹੋ ਗਿਆ ਦੁੱਧ ਹੋ ਗਿਆ ਕੁਛ ਵੀ ਸਟੇਸ਼ਨਰੀ ਦਾ ਸਮਾਨ ਹੋ ਗਿਆ ਅਸੀਂ ਉਹ ਮੰਗਵਾ ਸਕਦੇ ਹਾਂ ਅਤੇ ਉਹਨਾਂ ਦਾ ਡਿਲੀਵਰੀ ਟਾਈਮ ਦਸ ਮਿੰਟ ਦੇ ਵਿੱਚ ਹੀ ਪਹੁੰਚਾਉਣਾ ਹੁੰਦਾ ਹੈ ਅਤੇ ਇਹ ਜਿਹੜੇ ਡਿਲ ਡਿਲੀਵਰੀ ਹੈ ਉਹ ਸਾਨੂੰ ਅੱਧੇ ਘੰਟੇ ਵਿੱਚ ਵੀ ਹੋ ਜਾਂਦੀ ਹੈ ਜੇ ਅੱਧੇ ਘੰਟੇ ਤੋਂ ਬਾਅਦ ਡਿਲੀਵਰੀ ਹੋਵੇ ਤਾਂ ਜਿਹੜੇ ਡਿਲੀਵਰੀ ਕਰਨ ਵਾਲੇ ਹੁੰਦੇ ਹਨ ਉਹਨਾਂ ਦੀ ਤਨਖਾਹ ਵੀ ਕੱਟੀ ਜਾਂਦੀ ਹੈ ਅਤੇ ਜਿਹੜਾ ਜੋਮੈਟੋ ਐਪ ਹੈ ਇਹ ਇਹਨਾਂ ਦੀ ਇਹ ਇੱਥੋਂ ਅਸੀਂ ਖਾਣ ਪੀਣ ਦਾ ਸਮਾਨ ਮੰਗਵਾ ਸਕਦੇ ਹਾਂ ਜਿੱਦਾਂ ਕਿ ਕੇਕ ਹੋ ਗਿਆ ਰੋਟੀ ਹੋ ਗਈ ਸਬਜ਼ੀ ਹੋ ਗਈ ਹੋਰ ਵੀ ਖਾਣ ਪੀਣ ਦਾ ਸਮਾਨ ਅਸੀਂ ਮੰਗਵਾ ਸਕਦੇ ਹਾਂ ਘਰ ਬੈਠੇ ਹੀ ਅਤੇ ਜਿਹੜੀ ਅੱਜ ਕੱਲ੍ਹ ਦੀ ਟੈਕਨੋਲੋਜੀ ਹੈ ਉਹ ਸਾਡੇ ਕਾਰੋਬਾਰ ਨੂੰ ਇੱਦਾਂ ਹੀ ਬਦਲ ਰਹੀ ਹੈ ਧੰਨਵਾਦ